ਪੰਜਾਬ ਵਿੱਚ ਮੀਡੀਆ ਆਪਣੀ ਰਿਪੋਰਟਿੰਗ ਜਾਂ ਫੈਸਲੇ ਲੈਣ ਬਾਰੇ ਸੂਚਿਤ ਕਰਨ ਲਈ ਡੇਟੇ ਨੂੰ ਡੇਟਾ ਅਲੱਗ ਅਲੱਗ ਤਰੀਕੇ ਨਾਲ ਇਕੱਠੇ ਕਰਦੀ ਹੈ ਅਤੇ ਉਸ ਆਧਾਰ 'ਤੇ ਵਿਸ਼ਲੇਸ਼ਣ ਕੀਤਾ ਜਾਂਦਾ ਹੈ ਅਤੇ ਜਦੋਂ ਵੀ ਪੰਜਾਬ ਵਿੱਚ ਕੋਈ ਵੀ ਉਹਨੇ ਰਿਪੋਰਟਿੰਗ ਜਾਂ ਫੈਸਲੇ ਕਰਨੇ ਹੁੰਦੇ ਹਨ ਉਸ ਬਾਰੇ ਉਹ ਟਰਸਟਿਡ ਸੋਰਸਿਸ ਦੁਆਰਾ ਟਰਸਟਿਡ ਸਾਧਨਾਂ ਦੁਆਰਾ ਪਹਿਲਾਂ ਡਾਟਾ ਕਲੈਕਟ ਕਰਦੀ ਹੈ ਇਕੱਠਾ ਕਰਦੀ ਹੈ ਫਿਰ ਉਸ ਦਾ ਵਿਸ਼ਲੇਸ਼ਣ ਕੀਤਾ ਜਾਂਦਾ ਹੈ ਅਤੇ ਫਿਰ ਉਸ ਆਧਾਰ 'ਤੇ ਫੈਸਲੇ ਸੁਣਾਏ ਜਾਂਦੇ ਹਨ ਕਹਿੰਦੇ ਜਦੋਂ ਵੀ ਟੈਕਨੋਲਜੀ ਇੱਕ ਅਜਿਹਾ ਮਤਲਬ ਫਿਰ ਇਹ ਟੈਕਨੋਲਜੀ ਨਾਲ ਇਹ ਚੀਜ਼ਾਂ ਜੁੜਦੀਆਂ ਹਨ ਕਿਉਂਕਿ ਡਾਟਾ ਆਪਾਂ ਕਿਸੇ ਮੈਨੂਲੀ ਇੱਕ ਇੱਕ ਇੱਕ ਪਰਸਨ ਕੋਲ ਜਾ ਕੇ ਇੱਕ ਇੱਕ ਵਿਅਕਤੀ ਕੋਲ ਜਾ ਕੇ ਨਹੀਂ ਕਲੈਕਟ ਕਰ ਸਕਦੇ ਕਹਿੰਦੇ ਫਿਰ ਇੱਕ ਮਤਲਬ ਟਰਸਟਿਡ ਕੋਈ ਮਤਲਬ ਕਿਫਾ ਇਹੋ ਜਿਹੇ ਡਾਟਾ ਰਿਸੋਰਸਿਸ ਨੂੰ ਦੇਖਿਆ ਜਾਂਦਾ ਹੈ ਲੱਭਿਆ ਜਾਂਦਾ ਹੈ ਜਿਹਦੇ ਆਧਾਰ 'ਤੇ ਆਪਾਂ ਉਹਦਾ ਵਿਸ਼ਲੇਸ਼ਣ ਕਰਕੇ ਸਹੀ ਫੈਸਲੇ ਤੱਕ ਪਹੁੰਚ ਸਕੀਏ ਇਸ ਤਰ੍ਹਾਂ ਪੰਜਾਬ ਵਿੱਚ ਵੀ ਮੀਡੀਆ ਇੱਕ ਅਜਿਹਾ ਲੈਵਲ ਹੈਗਾ ਅਜਿਹਾ ਸੈਕਟਰ ਹੈ ਜਿਹਦੇ ਆਧਾਰ 'ਤੇ ਸਾਨੂੰ ਹਰ ਫੈਸਲੇ ਦੀ ਬਹੁਤ ਚੰਗੀ ਤਰ੍ਹਾਂ ਮਤਲਬ ਜਾਣਕਾਰੀ ਮਿਲ ਜਾਂਦੀ ਹੈ ਇਹ ਅਤੇ ਮੀਡੀਆ ਦਾ ਕੀ ਕੰਮ ਹੁੰਦਾ ਪਹਿਲਾਂ ਸਾਰੇ ਟਰਸਟਿਡ ਉਹਨੇ ਸੋਰਸਿਸ ਛੱਡੇ ਹੁੰਦੇ ਹੈ ਜਿਹਦੇ ਦੁਆਰਾ ਆਧਾਰ 'ਤੇ ਉਹ ਸਾਰੀ ਨਿਊਜ਼ ਜਿਹੜੀ ਹੈ ਉਹ ਇਕੱਠਾ ਕਰਦੀ ਹੈ ਹਰ ਅੱਡ ਅੱਡ ਸੋਰਸਿਸ ਦੁਆਰਾ ਕਈ ਵਾਰੀ ਉਹ ਖੁਦ ਪ੍ਰੈਜੈਂਟ ਹੋ ਕੇ ਕਈ ਵਾਰੀ ਆਪਾਂ ਕਹਿ ਲਓ ਵੀ ਅਨੈਲਸਿਸ ਕਰਨ ਲਈ ਉਹ ਮਤਲਬ ਕਿਸੇ ਵੀ ਮੀਡੀਆ 'ਚੋਂ ਪਾ ਸਕਦਾ ਵੀ ਹਾਂ ਇਹ ਜੋ ਹੋ ਰਿਹਾ ਕੀ ਇਹ ਸਹੀ ਹੈ ਜਾਂ ਗਲਤ ਹੈ ਜੇ ਗਲਤ ਹੈ ਤਾਂ ਕਿਸ ਲਈ ਗਲਤ ਹੈ ਜੇ ਸਹੀ ਹੈ ਤਾਂ ਕਿਸ ਹੱਦ ਤੱਕ ਸਹੀ ਹੈ ਅਤੇ ਕਹਿੰਦੇ ਇਹ ਜਿਹੜੇ ਆਧਾਰ ਹੈ ਜਿਹਦੇ ਆਧਾਰ 'ਤੇ ਪੰਜਾਬ ਵਿੱਚ ਜਿਹੜੀ ਮੀਡੀਆ ਹੈ ਆਪਣੇ ਰਿਪੋਰਟਿੰਗ ਜਾਂ ਫੈਸਲੇ ਲੈਣ ਵਿੱਚ ਪੂਰੀ ਤਰ੍ਹਾਂ ਸਕਸ਼ਮ ਹੋ ਪਾਈ ਹੈ ਅਤੇ ਇਹ ਡਾਟਾ ਕਲੈਕਟ ਕਰਨਾ ਵੀ ਓਨਾ ਔਖਾ ਨਹੀਂ ਹੁੰਦਾ ਪਰ ਇਹ ਟਰਸਟਿਡ ਰਿਸੋਰਸਿਸ ਹੁੰਦੇ ਜਿਹਦੇ ਆਧਾਰ 'ਤੇ ਆਪਾਂ ਸਹੀ ਫੈਸਲਾ ਲੈਣ ਵਿੱਚ ਸਕਸ਼ਮ ਹੋ ਪਾਉਂਦੇ ਹਾਂ